ਮੈਂ ਕੁਛ ਸਮਾਂ ਪਹਿਲਾਂ ਇਹ ਖਾਣ ਪੀਣ ਦੀ ਮੇਜ਼ ਖਰੀਦੀ ਸੀ ਪਰ ਇਹ ਮੇਰੀ ਉਮੀਦਾਂ 'ਤੇ ਪੂਰੀ ਨਹੀਂ ਉਤਰੀ ਸਭ ਤੋਂ ਵੱਡੀ ਸਮੱਸਿਆ ਇਸਦੀ ਕੁਆਲਿਟੀ ਹੈ ਲੱਕੜ ਬਹੁਤ ਹੀ ਹਲਕਾ ਅਤੇ ਨਾਜ਼ੁਕ ਹੈ ਬੇਹੱਦ ਮਜ਼ਬੂਤ ਦਿਖਣ ਦੇ ਬਾਵਜੂਦ ਇਹ ਮੇਜ਼ ਆਸਾਨੀ ਨਾਲ ਹਿਲ ਜਾਂਦੀ ਹੈ ਅਤੇ ਕਈ ਵਾਰ ਲੜਖੜਾਉਂਦੀ ਹੈ ਇਲਾਵਾ ਇਸ ਦੀ ਪੇਂਟਿੰਗ ਅਤੇ ਪੋਲਿਸ਼ ਵੀ ਘਟੀਆ ਗੁਣਵੱਤਾ ਵਾਲੀ ਹੈ ਸਿਰਫ ਕੁਝ ਹਫਤਿਆਂ 'ਚ ਹੀ ਪੋਲਿਸ਼ ਉਤਰਨ ਲੱਗੀ ਅਤੇ ਕੋਨਿਆਂ ਘਰਾਂ ਕੋਨਿਆਂ ਤੋਂ ਲੱਕੜ ਫੱਟਣਾ ਸ਼ੁਰੂ ਹੋਗੀ ਇੱਕ ਹੋਰ ਨਿਰਾਸ਼ਾਜਨਕ ਗੱਲ ਇਹ ਸੀ ਕਿ ਵੇਲੇ ਅਤੇ ਡਿਲੀਵਰੀ ਨਹੀਂ ਹੋਈ ਮੈਨੂੰ ਦੱਸਿਆ ਗਿਆ ਸੀ ਪੰਜ ਦਿਨਾਂ ਵਿੱਚ ਆ ਜਾਵੇਗੀ ਪਰ ਇਹ ਤਾਂ ਹਫਤੇ ਦੇ ਤੋਂ ਬਾਅਦ ਹੀ ਆਈ ਕੁੱਲ ਮਿਲਾ ਕੇ ਮੇਜ਼ ਨਾ ਹੀ ਤਾਂ ਮਜ਼ਬੂਤ ਹੈ ਨਾ ਹੀ ਲੰਬੇ ਸਮੇਂ ਤੱਕ ਚੱਲਣ ਵਾਲੀ ਏ ਇਹ ਖਰੀਦਣਾ ਪੈਸਿਆਂ ਦੀ ਬਰਬਾਦੀ ਰਹੀ ਮੇਰੀ ਬਿਲਕੁਲ ਮੈਂ ਕਿਸੇ ਨੂੰ ਵੀ ਇਹ ਮੇਜ਼ ਲੈਣ ਦੀ ਸਲਾਹ ਨਹੀਂ ਦੇਵਾਂਗਾ